ਮੈਂ ਮਮਤਾ ਦੇਵੀ ਵਾਸੀ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਯੋਗਾ ਕਲਾਸ ਬਾਰੇ ਯੋਗਾ ਕਲਾਸ ਲਗਾਉਣਾ ਜਦੋਂ ਅਸੀਂ ਕਿਸੇ ਸ਼ਿੱਬਰ ਵਿੱਚ ਜਾ ਕੇ ਯੋਗਾ ਦੀ ਕਲਾਸ ਲਾਉਂਦੇ ਹਾਂ ਜਾਂ ਟੀਵੀ ਰਾਹੀਂ ਯੋਗਾ ਦੀ ਕਲਾਸ ਨੂੰ ਦੇਖਦੇ ਹਾਂ ਤਾਂ ਸਾਨੂੰ ਕਈ ਗੱਲਾਂ ਦਾ ਪਤਾ ਲੱਗਦਾ ਹੈ ਜੋ ਅਸੀਂ ਘਰ ਵਿੱਚ ਆਪਣੇ ਆਪ ਕੀਤੇ ਯੋਗਾ ਨਾਲੋਂ ਕਈ ਗੁਣਾ ਜਾਂ ਕਈ ਗੱਲਾਂ ਤੋਂ ਵੱਖਰਾ ਹੋ ਕੇ ਨਿਬਾ ਸਿੱਖਦੇ ਹਾਂ ਕਿਉਂਕਿ ਜਿਹੜੇ ਯੋਗਾ ਕਲਾਸ ਲਗਾਉਂਦੇ ਹਨ ਉਹਨਾਂ ਨੂੰ ਕੋਰਸ ਕੀਤੇ ਉ ਉਹਨਾਂ ਨੇ ਥਾਂ ਥਾਂ 'ਤੇ ਸ਼ਿੱਬਰ ਲਗਾਏ ਅਤੇ ਉਹਨਾਂ ਨੇ ਥਾਂ ਥਾਂ ਤੋਂ ਸਿੱਖੀਆਂ ਗੱਲਾਂ ਹਨ ਸਿੱਖੀਆਂ ਅਭਿਆਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਟੀਚਾ ਮਿੱਥਿਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਘਰ ਵਿੱਚ ਇਕੱਲੇ ਯੋਗਾ ਕਰਦੇ ਹਾਂ ਤਾਂ ਅਸੀਂ ਕਿਸੇ ਅਭਿਆਸ ਨੂੰ ਵੱਧ ਕਰ ਦਿੰਦੇ ਹਾਂ ਅਤੇ ਜਾਂ ਘੱਟ ਕਰ ਦਿੰਦੇ ਹਾਂ ਜੋ ਕਿ ਯੋਗਾ ਕਰਨ ਦੀ ਪ੍ਰਕਿਰਿਆ ਤੋਂ ਵੱਖਰਾ ਹੋ ਨਿਬੜਦਾ ਹੈ ਜਿਸ ਤਰ੍ਹਾਂ ਅਸੀਂ ਜਦੋਂ ਸਵੇਰੇ ਸਾਰ ਟੀਵੀ ਲਗਾਉਂਦੇ ਹਾਂ ਤਾਂ ਬਾਬਾ ਰਾਮਦੇਵ ਜੀ ਯੋਗਾ ਕਲਾਸ ਦੇਖਦੇ ਹਾਂ ਤਾਂ ਉਸ ਵਿੱਚ ਪਤਾ ਲੱਗਦਾ ਹੈ ਕਿ ਉਹ ਕਿਸ ਤਰ੍ਹਾਂ ਯੋਗਾ ਕਰਦੇ ਹਨ ਅਤੇ ਕਿਸ ਤਰ੍ਹਾਂ ਲੋਕਾਂ ਨੂੰ ਯੋਗਾ ਕਰਨ ਵਾਸਤੇ ਕਹਿੰਦੇ ਹਨ ਜੇਕਰ ਅਸੀਂ ਉਹਨਾਂ ਦਾ ਯੋਗਾ ਕਲਾਸ ਨੂੰ ਦੇਖੀਏ ਤਾਂ ਸਾਨੂੰ ਕਈ ਆਪਣੇ ਘਰਾਂ ਵਿੱਚ ਲਗਾਏ ਯੋਗਾ ਕਲਾਸਾਂ ਵਿੱਚੋਂ ਕਈ ਕਈ ਉਣਤੀਆਂ ਸਾਹਮਣੇ ਆ ਜਾਂਦੀਆਂ ਹਨ ਘਾਟਾ ਦਿਖਾਈ ਦਿੰਦੀਆਂ ਹਨ ਇਸ ਕਰਕੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਦੋਂ ਅਸੀਂ ਕੋਈ ਵੀ ਕਲਾਸ ਲਗਾਂਗੇ ਯੋਗਾ ਕਰਦੇ ਹਾਂ ਤਾਂ ਉਸ ਵਿੱਚ ਸਾਨੂੰ ਬੜੀਆਂ ਹੀ ਗੱਲਾਂ ਦਾ ਪਤਾ ਲੱਗਦਾ ਹੈ ਕਿ ਸਾਨੂੰ ਸਮੇਂ ਦੇ ਮੁਤਾਬਿਕ ਯੋਗਾ ਦੀ ਸਿੱਖਿਆ ਮਿਲਦੀ ਹੈ ਧੰਨਵਾਦ